ਬੋਲੀਵੁੱਡ ਬੋਲੀਵੁੱਡ ਨੇ ਇੱਦਾਂ ਦੀਆਂ ਫਿਲਮਾਂ ਦਿੱਤੀਆਂ ਹਨ ਜੋ ਕਿ ਬਹੁਤ ਮਜੇਦਾਰ ਹੈ ਕਈ ਮੂਵੀਜ ਐਕਸ਼ਨ ਕਈ ਕੋਮੇਡੀ ਅਤੇ ਕਈ ਇਮੋਸ਼ਨਲ ਅਤੇ ਹਰ ਮੂਵੀ ਦੀ ਬੜੀ ਵਧੀਆਂ ਸਟੋਰੀ ਹੁੰਦੀ ਹੈ ਅੱਜ ਤੁਹਾਨੂੰ ਮੈਂ ਆਪਣੀ ਮਨ ਪਸੰਦ ਫਿਲਮ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ ਮੈਂ ਕੇ ਜੀ ਐਫ ਇਹ ਇੱਕ ਬੋਲੀਵੁੱਡ ਫਿਲਮ ਹੈ ਇਸ ਦਾ ਹੀਰੋ ਯਸ਼ ਹੈ ਜਿਸ ਨੇ ਬਹੁਤ ਵਧੀਆ ਐਕਟਿੰਗ ਕੀਤੀ ਜਿਸ ਵਿੱਚ ਐਕਸ਼ਨ ਵੀ ਸੀ ਕੋਮੇਡੀ ਵੀ ਸੀ ਅਤੇ ਇਮੋਸ਼ਨ ਵੀ ਸੀ ਉਹ ਫਿਲਮ ਇਹ ਸਿਖਾਉਂਦੀ ਹੈ ਕਿ ਸਾਨੂੰ ਆਤਮ ਨਿਰਭਰ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਕਿਸੇ 'ਤੇ ਵੀ ਡਿਪੈਂਡ ਨਹੀਂ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਪਰਿਵਾਰ ਵਾਲਿਆਂ ਦੀ ਇੱਜਤ ਕਰਨੀ ਚਾਹੀਦੀ ਹੈ ਅਤੇ ਸਭ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਹੈ ਇਸ ਵਿੱਚ ਅਦਾਕਾਰਾ ਦਾ ਰੋਲ ਸਾਊਥ ਐਕਟਰਸ ਨੇ ਕੀਤਾ ਉਹ ਵੀ ਹੁਣ ਇਸ ਫਿਲਮ ਤੇ ਬਹੁਤ ਅੱਗੇ ਆ ਗਈ ਅਤੇ ਬਹੁਤ ਨਾਮ ਬਣਾ ਲਿਆ ਉਸਨੇ ਲੋਕਾਂ 'ਚ